ਜੀ ਹਾਂ ਮੈਨੂੰ ਮਾਰਸ਼ਲ ਆਰਟ ਵਿੱਚ ਦੂਜਿਆਂ ਨੂੰ ਸਿਖਾਉਣ ਦਾ ਮੌਕਾ ਮਿਲਿਆ ਸੀ ਮੈਂ ਉਹਨਾਂ ਬੱਚਿਆਂ ਨੂੰ ਬਹੁਤ ਚ ਚੰਗੇ ਤਰੀਕੇ ਨਾਲ ਕੋਚ ਕੀਤਾ ਸੀ ਮੈਨੂੰ ਇਹ ਮੌਕਾ ਆਪਣੇ ਸਕੂਲ ਵਿੱਚ ਮਿਲਿਆ ਸੀ ਜਦੋਂ ਮੈਂ ਬਾਰਵੀਂ ਜਮਾਤ ਵਿੱਚ ਪੜ੍ਹਦੀ ਸੀ ਮੈਨੂੰ ਇਹ ਬਹੁਤ ਵਧੀਆ ਮੌਕਾ ਲੱਗਿਆ ਜਿਸ ਦੇ ਨਾਲ ਮੈਨੂੰ ਬੱਚਿਆਂ ਨੂੰ ਸਿਖਾਉਣ ਤੋਂ ਬਾਅਦ ਉਹਨਾਂ ਦੀਆਂ ਜ਼ਿਲ੍ਹਾ ਪੱਧਰ ਵਿੱਚ ਬਹੁਤ ਸਾਰੀਆਂ ਪੁਜੀਸ਼ਨਾਂ ਵੀ ਹਾਸਿਲ ਕੀਤੀਆਂ ਸਨ